ਕਾਨੂੰਨੀ ਦਸਤਾਵੇਜ਼ ਬਣਾਉਣ ਦੇ ਲਈ ਮੇਰਾ ਐਕਸਪੀਰੀਅਅੰਸ ਵਧੀਆ ਹੀ ਰਿਹਾ ਕਿਉਂਕਿ ਅੱਜ ਕੱਲ੍ਹ ਸਰਕਾਰਾਂ ਨੇ ਸੁਵਿਧਾ ਕੇਂਦਰ ਬਣਾਏ ਹੋਏ ਹਨ ਜਿਹਦੇ ਵਿੱਚ ਸਾਨੂੰ ਹਰ ਤਰ੍ਹਾਂ ਦੇ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਸੁਵਿਧਾ ਪ੍ਰਾਪਤ ਹੈ ਮੇਰਾ ਐਕਸਪੀਰੀਅੰਸ ਜਿਵੇਂ ਕਿ ਮੈਂ ਆਪਣਾ ਡਰਾਈਵਿੰਗ ਲਾਇਸੈਂਸ ਬਣਵਾਉਣਾ ਸੀਗਾ ਮੈਂ ਡਰਾਈਵਿੰਗ ਲਾਇਸੈਂਸ ਦੇ ਲਈ ਅਪਲਾਈ ਕੀਤਾ ਅਤੇ ਉਸ ਤੋਂ ਪਹਿਲਾਂ ਮੇਰਾ ਲਰਨਰ ਬਣਿਆ ਅਤੇ ਉਸ ਤੋਂ ਬਾਅਦ ਲਰਨਰ ਤੋਂ ਕੁਝ ਦਿਨਾਂ ਬਾਅਦ ਹੀ ਫਿਰ ਮੈਨੂੰ ਮੇਰਾ ਡਰਾਈਵਿੰਗ ਲਾਇਸੈਂਸ ਮਿਲ ਗਿਆ ਉਸ ਤੋਂ ਬਾਅਦ ਮੇਰਾ ਇੱਕ ਹੋਰ ਐਕਸਪੀਰੀਅੰਸ ਰਿਹਾ ਕਿ ਮੈਂ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣਾ ਸੀ ਆਧਾਰ ਕਾਰਡ ਅਪਡੇਟ ਕਰਵਾਉਣ ਦੇ ਲਈ ਮੈਨੂੰ ਸੁਵਿਧਾ ਕੇਂਦਰ ਜਾਣਾ ਪਿਆ ਮੈਂ ਆਪਣੇ ਆਧਾਰ ਕਾਰਡ ਦਾ ਐਡਰੈਸ ਅਪਡੇਟ ਕਰਵਾਉਣਾ ਸੀ ਉਹਦੇ ਵਿੱਚ ਉਹਨਾਂ ਨੇ ਮੇਰੇ ਤੋਂ ਕੁਛ ਡੋਕੂਮੈਂਟ ਮੰਗੇ ਮੈਂ ਉਹ ਡੋਕੂਮੈਂਟ ਪ੍ਰੋਵਾਈਡ ਕੀਤੇ ਅਤੇ ਇੱਕ ਦੋ ਦਿਨਾਂ ਦੇ ਵਿੱਚ ਹੀ ਮੇਰਾ ਆਧਾਰ ਕਾਰਡ ਅਪਡੇਟ ਹੋ ਗਿਆ ਜਿਹੜੇ ਕਿ ਸੁਵਿਧਾ ਸੈਂਟਰ ਬਣੇ ਹਨ ਉਹ ਉਹ ਕਾਨੂੰਨੀ ਦਸਤਾਵੇਜ਼ ਨੂੰ ਬਣਾਉਣ ਦੇ ਵਿੱਚ ਸਾਡੇ ਲਈ ਬਹੁਤ ਵਧੀਆ ਹੈਲਪ ਕਰਦੇ ਨੇ ਅਤੇ ਸਾਡਾ ਸਮਾਂ ਵੀ ਘੱਟ ਲੱਗਦਾ ਹੈ ਪਰ ਮੈਂ ਚਾਹੁੰਦੀ ਹਾਂ ਕਿ ਕੁਛ ਸੁਵਿਧਾਵਾਂ ਐਸੀਆਂ ਹੋਣੀਆਂ ਚਾਹੀਦੀਆਂ ਹਨ ਜਿਹੜੀਆਂ ਅਸੀਂ ਘਰ ਬੈਠੇ ਹੀ ਔਨਲਾਈਨ ਅਪਲਾਈ ਕਰਕੇ ਉਹਨਾਂ ਨੂੰ ਔਨਲਾਈਨ ਹੀ ਉਪਲਬਧ ਕਰ ਸਕੀਏ